ਸਾਡੇ ਖੇਤਰ ਵਿੱਚ ਰਵਾਇਤੀ ਖੇਡਾਂ ਨੂੰ ਸੁਰੱਖਿਅਤ ਰੱਖਣ ਲਈ ਕਾਫ਼ੀ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਜਿਵੇਂ ਕਿ ਸਾਡੇ ਨੇੜਲੇ ਦੇ ਖੇਤਰਾਂ ਵਿੱਚ ਪੁਰਾਣੀਆਂ ਖੇਡਾਂ ਕਰਵਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਇਨਾਮ ਵੀ ਰੱਖੇ ਜਾਂਦੇ ਹਨ ਕਿ ਜੇਕਰ ਕੋਈ ਪਹਿਲੇ ਸਥਾਨ ਉੱਤੇ ਆਉਂਦਾ ਹੈ ਤਾਂ ਉਸਨੂੰ ਬਿਆਲੀ ਹਜ਼ਾਰ ਇਨਾਮ ਮਿਲਦਾ ਹੈ ਅਗਰ ਕੋਈ ਦੂਜੇ ਸਥਾਨ 'ਤੇ ਆਉਂਦਾ ਹੈ ਤਾਂ ਉਸਨੂੰ ਵੀਹ ਹਜ਼ਾਰ ਇਨਾਮ ਮਿਲਦਾ ਹੈ ਇੱਦਾਂ ਦੇ ਇਨਾਮ ਸਾਡੇ ਖੇਤਰਾਂ ਵਿੱਚ ਕਰਵਾਈ ਜਾਣ ਵਾਲੀਆਂ ਖੇਡਾਂ ਵਿੱਚ ਰੱਖੇ ਜਾਂਦੇ ਹਨ ਜਿਸ ਨਾਲ ਕਿ ਉਹ ਰਵਾਇਤੀ ਖੇਡਾਂ ਨੂੰ ਸੁਰੱਖਿਅਤ ਕਰਨ ਦੇ ਉਪਰਾਲੇ ਹਨ ਅਤੇ ਹੋਰ ਵੀ ਕਈ ਤਰ੍ਹਾਂ ਦੇ ਉਪਰਾਲੇ ਰਵਾਇਤੀ ਖੇਡਾਂ ਨੂੰ ਸੁਰੱਖਿਅਤ ਰੱਖਣ ਲਈ ਕੀਤੇ ਜਾਂਦੇ ਹਨ ਜਿਸ ਨਾਲ ਕਿ ਸਾਡੀਆਂ ਜੋ ਰਵਾਇਤੀ ਖੇਡਾਂ ਹਨ ਲੋਕ ਉਹਨਾਂ ਨੂੰ ਵੀ ਨਾ ਭੁੱਲਣ ਅਤੇ ਉਹ ਵੀ ਸਭ ਨੂੰ ਉਹਨਾਂ ਬਾਰੇ ਪਤਾ ਹੋਵੇ